ਮੇਰਾ ਨਾਮ ਸ਼ਬਨਮਦੀਪ ਕੌਰ ਹੈ ਮੇਰੇ ਪਤੀ ਦਾ ਨਾਮ ਦਰਬਾਰਾ ਸਿੰਘ ਹੈ ਅਸੀਂ ਮੇਨ ਬਾਜ਼ਾਰ ਹੰਡਿਆਇਆ ਡਿਸਟਰਿਕ ਬਰਨਾਲਾ ਵਿੱਚ ਰਹਿੰਦੇ ਹਾਂ ਮੇਰੇ ਪਤੀ ਐਸ ਬੀ ਆਈ ਬੈਂਕ ਵਿੱਚ ਨੌਕਰੀ ਕਰਦੇ ਹਨ ਹੁਣ ਉਹਨਾਂ ਦੀ ਟਰਾਂਸਫਰ ਹਰਿਆਣਾ ਵਿੱਚ ਹੋ ਗਈ ਹੈ ਇਸ ਲਈ ਸਾਡੀ ਸਾਰੀ ਫੈਮਲੀ ਉਥੇ ਸ਼ਿਫਟ ਹੋ ਰਹੀ ਹੈ ਇਸ ਲਈ ਮੈਂ ਚਾਹੁੰਦੀ ਹਾਂ ਕਿ ਸਾਡੀ ਗੈਸ ਆਈਡੀ ਕੋਡ ਸਾਡੀ ਗੈਸ ਆਈਡੀ ਕੋਡ ਪੁਰਾਣੇ ਪਤੇ ਤੋਂ ਨਵੇਂ ਪਤੇ ਵਿੱਚ ਅਪਡੇਟ ਕੀਤਾ ਜਾਵੇ ਇਸ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਸਾਡੀ ਪੁਰਾਣੀ ਗੈਸ ਆਈਡੀ ਕੋਡ ਕੇ ਐਸ ਸੱਤ ਦੋ ਪੰਜ ਇੱਕ ਜੀਰੋ ਜੀਰੋ ਤਿੰਨ ਸੱਤ ਹੈ ਇਸ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਸਾਡੇ ਗੈਸ ਏਜੰਸੀ ਦਾ ਨਾਮ ਇੰਨਡੈਨ ਹੈ ਸਾਡਾ ਨਵਾਂ ਐਡਰੈਸ ਹਰਿਆਣਾ ਡਿਸਟ੍ਰਿਕ ਹਿਸਾਰ ਹੈ ਮੇਰੀ ਪੁਰਾਣੀ ਆਈਡੀ ਕੋਡ ਨੂੰ ਅਪਡੇਟ ਕੀਤਾ ਜਾਵੇ ਤਾਂ ਜੋ ਮੈਂ ਜਲਦ ਤੋਂ ਜਲਦ ਉੱਥੇ ਸ਼ਿਫਟ ਹੋ ਸਕਾਂ ਤੇ ਮੈਨੂੰ ਰਹਿਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਹੁਣ ਮੈਨੂੰ ਨਵੇਂ ਗੈਸ ਆਈਡੀ ਕੋਡ ਦੀ ਕਾਪੀ ਦਿੱਤੀ ਜਾਵੇ ਤੇ ਸਾਡਾ ਪੁਰਾਣਾ ਆਈਡੀ ਕੋਡ ਬੰਦ ਕੀਤਾ ਜਾਵੇ ਧੰਨਵਾਦ